ਪੰਜਾਬ ਵਿੱਚ ਬਾਹਰ ਜਾਣ ਅਤੇ ਮਸਤੀ ਕਰਨ ਲਈ ਬਹੁਤ ਜਿਹੀਆਂ ਥਾਵਾਂ ਹਨ ਜਿਵੇਂ ਜਿਸ ਕੰਮ ਵਿੱਚ ਇੰਟਰਸਟ ਹੁੰਦਾ ਹੈ ਰੁਚੀ ਹੁੰਦੀ ਹੈ ਉਹ ਕੰਮ ਤੋਂ ਆਪਾਂ ਇੰਟਰਟੇਨ ਹੁੰਦੇ ਹਾਂ ਜੇ ਪੰਜਾਬ ਵਿੱਚ ਪੰਜਾਬ ਦੇ ਅੰਮ੍ਰਿਤਸਰ ਵਿੱਚ ਵੀ ਬਹੁਤ ਥਾਵਾਂ ਹਨ ਜਿਵੇਂ ਜਲਿਆਂਵਾਲਾ ਬਾਗ ਅਤੇ ਹੋਰ ਵੀ ਇਤਿਹਾਸਿਕ ਥਾਵਾਂ ਹਨ ਜਿੱਥੇ ਜਾ ਕੇ ਸਾਨੂੰ ਜਾਣਕਾਰੀ ਵੀ ਪ੍ਰਾਪਤ ਹੁੰਦੀ ਹੈ ਅਤੇ ਨਾਲ ਨਾਲ ਅਸੀਂ ਉੱਥੇ ਜਾ ਕੇ ਆਪਣੇ ਪਰਿਵਾਰ ਅਤੇ ਆਪਣੇ ਦੋਸਤਾਂ ਨਾਲ ਮਸਤੀ ਵੀ ਕਰ ਸਕਦੇ ਹਾਂ ਇਸ ਤੋਂ ਇਲਾਵਾ ਚੰਡੀਗੜ੍ਹ ਚੰਡੀਗੜ੍ਹ ਵੀ ਬਹੁਤ ਥਾਵਾਂ ਹਨ ਮਸਤੀ ਕਰਨ ਲਈ ਪਰੰਤੂ ਚੰਡੀਗੜ੍ਹ ਪੰਜਾਬ ਤੋਂ ਥੋੜ੍ਹਾ ਅੱਡ ਹੈ ਇਸ ਕਰਕੇ ਪੰਜਾਬ ਵਿੱਚ ਜਲੰਧਰ ਅੰਮ੍ਰਿਤਸਰ ਵਿੱਚ ਬਹੁਤ ਥਾਵਾਂ ਹਨ ਜਿੱਥੇ ਆਪਾਂ ਮਸਤੀ ਕਰ ਸਕਦੇ ਹਾਂ ਅਤੇ ਇਤਿਹਾਸਕ ਥਾਵਾਂ ਤੋਂ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹਾਂ ਜਿਵੇਂ ਟਾਈਗਰ ਸਫਾਰੀ ਜਲਿਆਂਵਾਲਾ ਬਾਗ ਅਮਿਊਜਮੈਂਟ ਪਾਰਕਸ ਅਤੇ ਹੋਰ ਵੀ ਧੰਨਵਾਦ